ਸਥਾਨਕ ਉਦਯੋਗ ਜਾਂ ਕਾਰੋਬਾਰ ਇਹ ਹੈ ਜਿਵੇਂ ਕਿ ਰੋਪੜ ਬੱਸ ਅੱਡਾ ਨਵਾਂ ਪੁਲ ਰੋਪੜ ਜਲੰਧਰ ਬਾਈਪਾਸ ਡੈਮ ਇਹ ਉਦਯੋਗ ਕਾਰੋਬਾਰ ਸਰਕਾਰਾਂ ਦੇ ਦੁਆਰਾ ਵਿਕਸਿਤ ਹੋਏ ਸਰਕਾਰਾਂ ਨੂੰ ਵੀ ਆਮ ਜਨਤਾ ਵੱਲੋਂ ਜ਼ੋਰ ਪਾਇਆ ਜਾਂਦਾ ਹੈ ਤਾਂ ਕਿ ਅਜਿਹੇ ਉਦਯੋਗ ਜਾਂ ਕਾਰੋਬਾਰ ਇਸ ਦੀ ਸਾਡੇ ਜ਼ਿਲ੍ਹੇ ਵਿੱਚ ਲੋੜ ਹੈ ਪਰ ਸਰਕਾਰਾਂ ਦੇ ਬਜਟ ਪੂਰੇ ਨਾ ਹੋਣ ਕਾਰਨ ਅਜਿਹੇ ਉਦਯੋਗਾਂ ਜਾਂ ਕਾਰੋਬਾਰਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ